ਮੈਨੂੰ ਟੀ ਵੀ 'ਤੇ ਆਉਣ ਵਾਲਾ ਕਪਿਲ ਸ਼ਰਮਾ ਸ਼ੋਅ ਬਹੁਤ ਪਸੰਦ ਹੈ ਇਹ ਸ਼ੋਅ ਸਾਡਾ ਸਾਰਾ ਪਰਿਵਾਰ ਮਿਲ ਕੇ ਦੇਖਦਾ ਹੈ ਸਾਨੂੰ ਹਰ ਸ਼ਨੀ ਐਤਵਾਰ ਇਸ ਦੀ ਇੰਤਜ਼ਾਰ ਰਹਿੰਦਾ ਹੈ ਇਸ ਦੇ ਵਿੱਚ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਉਹ ਹਿੱਸਾ ਲੈਂਦੇ ਨੇ ਇਹ ਕਲਾਕਾਰ ਅਲੱਗ ਅਲੱਗ ਤਰੀਕੇ ਦੇ ਨਾਲ ਸਾਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਨੇ ਇੱਕ ਪੂਰੇ ਹਫਤੇ ਦਾ ਥੱਕਿਆ ਹੋਇਆ ਬੰਦਾ ਜਦੋਂ ਇਸ ਸ਼ੋਅ ਨੂੰ ਦੇਖਦਾ ਹੈ ਤਾਂ ਆਪਣੇ ਆਪ ਹੀ ਉਹ ਖੁਸ਼ ਹੋ ਜਾਂਦਾ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਹਸਤੀਆਂ ਨੇ ਜਿਵੇਂ ਫਿਲਮਾਂ ਦੀਆਂ ਹਸਤੀਆਂ ਨੇ ਜਾਂ ਬਹੁਤ ਸਾਰੇ ਐਕਟਰਸ ਨੇ ਜਿਹੜੇ ਗੀਤਕਾਰ ਨੇ ਸੰਗੀਤਕਾਰ ਨੇ ਕੋਈ ਫਿਲਮਾਂ ਬਣਾਉਣ ਵਾਲੇ ਆ ਜਾਂ ਹੋਰ ਵੀ ਬਹੁਤ ਸਾਰੀਆਂ ਸਾਡੇ ਕ੍ਰਿਕਟ ਦੇ ਵਿੱਚ ਕੁਝ ਹਸਤੀਆਂ ਨੇ ਕੋਈ ਟੇਬਲ ਟੈਨਿਸ ਦੇ ਵਿੱਚ ਨੇ ਖੇਡਾਂ ਦੇ ਵਿੱਚ ਹਸਤੀਆਂ ਨੇ ਉਹਨਾਂ ਸਾਰਿਆਂ ਨੂੰ ਇੱਥੇ ਬੁਲਾਇਆ ਜਾਂਦਾ ਹੈ ਉਹਨਾਂ ਦੇ ਨਾਲ ਬਹੁਤ ਸਾਰਾ ਇਥੇ ਹਾਸਾ ਮਜ਼ਾਕ ਕੀਤਾ ਜਾਂਦਾ ਹੈ ਸਾਨੂੰ ਇਸ ਸ਼ੋਅ ਦੇ ਦੁਆਰਾ ਬਹੁਤ ਸਾਰੀਆਂ ਗੱਲਾਂ ਵੀ ਪਤਾ ਲੱਗਦੀਆਂ ਨੇ ਮੈਨੂੰ ਇਸ ਤਰ੍ਹਾਂ ਦੇ ਜਿਹੜੇ ਸ਼ੋਅ ਨੇ ਉਹ ਦੇਖਣੇ ਬੜੇ ਪਸੰਦ ਨੇ ਜਿਸ ਦੇ ਵਿੱਚ ਨਾਲੇ ਤਾਂ ਸਾਨੂੰ ਥੋੜ੍ਹਾ ਬਹੁਤ ਪਤਾ ਲੱਗਦਾ ਹੈ ਆਪਣੇ ਦੇਸ਼ ਦੇ ਬਾਰੇ 'ਚ ਦੇਸ਼ ਦੀਆਂ ਅੱਡ ਅੱਡ ਜਿਹੜੇ ਸਾਡੇ ਫੀਲਡ ਨੇ ਉਹਦੇ ਲੋਕਾਂ ਦੇ ਬਾਰੇ 'ਚ ਪਤਾ ਲੱਗਦਾ ਹੈ ਨਾਲ ਹੀ ਸਾਨੂੰ ਇਸ ਦੇ ਨਾਲ ਥੋੜ੍ਹਾ ਬਹੁਤ ਸਾਡਾ ਮਨੋਰੰਜਨ ਵੀ ਹੋ ਜਾਂਦਾ ਹੈ ਅਤੇ ਇਹਦੇ ਵਿੱਚ ਵਰਤੀ ਜਾਣ ਵਾਲੀ ਜਿਹੜੀ ਲੈਂਗੁਏਜ ਹੈ ਉਹ ਵੀ ਮੈਨੂੰ ਵਧੀਆ ਲੱਗਦੀ ਹੈ ਇਹਦੇ ਆਉਣ ਦੇ ਨਾਲ ਇਕਦਮ ਇਸ ਤਰਾਂ ਲੱਗਦਾ ਹੈ ਕਿਜਿਵੇਂ ਅਸੀਂ ਆਪਣਾ ਜਿਹੜਾ ਮਨ ਹੈ ਉਹ ਥੋੜ੍ਹਾ ਜਿਹਾ ਸ਼ਾਂਤ ਹੋ ਰਿਹਾ ਹੈ ਅਤੇ ਇਹ ਵਧੀਆ ਤਰੀਕੇ ਦੇ ਨਾਲ ਇਸਨੂੰ ਪੇਸ਼ ਕੀਤਾ ਜਾਂਦਾ ਹੈ ਇਹਦੀ ਮੈਨੂੰ ਪੇਸ਼ਕਾਰੀ ਬਹੁਤ ਪਸੰਦ ਹੈ ਇਹਦੇ ਵਿੱਚ ਜਦੋਂ ਕਪਿਲ ਸ਼ਰਮਾ ਜਿਹੜਾ ਹੈ ਉਹ ਨਾਲ ਥੋੜ੍ਹੇ ਬਹੁਤ ਗਾਣੇ ਵੀ ਸੁਣਾ ਦਿੰਦਾ ਹੈ ਜੋ ਕਿ ਵਧੀਆ ਲੱਗਦੇ ਨੇ ਸੰਗੀਤ ਜਿਹੜਾ ਹੈ ਸਾਡੀ ਰੂਹ ਨੂੰ ਸਕੂਨ ਦਿੰਦਾ ਹੈ ਅਤੇ ਉਹਦਾ ਜਿਹੜਾ ਇਹ ਸੰਗੀਤ ਹੈ ਇਹ ਵੀ ਮੈਨੂੰ ਪਸੰਦ ਹੈ ਉਹਦੀ ਐਕਟਿੰਗ ਪਸੰਦ ਹੈ ਉਹਦੀ ਸਾਰੀ ਟੀਮ ਮੈਨੂੰ ਬੜੀ ਪਸੰਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਹੈ ਅਤੇ ਮੈਂ ਹਮੇਸ਼ਾ ਚਾਹੁੰਦੀ ਹਾਂ ਕਿ ਇਸ ਤਰ੍ਹਾਂ ਦੇ ਸ਼ੋਅ ਜਿਹੜੇ ਨੇ ਟੀ ਵੀ 'ਚ ਆਉਂਦੇ ਰਹਿਣ